ਮੈਂ ਸਿੱਖ ਧਰਮ ਨਾਲ ਸੰਬੰਧਿਤ ਹਾਂ ਕਿ ਸਾਡੇ ਸਿੱਖ ਧਰਮ ਦੀ ਸੇਵਾ ਸਿੱਖਿਆ ਚ ਸਿੱਖਿਆ ਦਿੱਤੀ ਜਾਂਦੀ ਹੈ ਕਿ ਪਹਿਲ ਦਿੱਤੀ ਜਾਂਦੀ ਹੈ ਇਹ ਸਿੱਖਿਆ ਸਾਡੇ ਗੁਰੂ ਦੀ ਦੇਣ ਹੈ ਅਸੀਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਸਿੱਖਿਆ ਹੈ ਕਿ ਜਿਸ ਸਮੇਂ ਸਾਡੇ ਸਮਾਜ ਵਿੱਚ ਕੋਈ ਬਿਮਾਰੀ ਆ ਜਾਵੇ ਔਕੜ ਆ ਜਾਵੇ ਭੁੱਖਮਰੀ ਹੋ ਜਾਵੇ ਹੜ੍ਹ ਹੋਣ ਤਾਂ ਸਾਡੀ ਸਿੱਖ ਕੌਮ ਸਭ ਤੋਂ ਅੱਗੇ ਰਹਿੰਦੀ ਹੈ ਹੁਣ ਅਸੀਂ ਅਜੇ ਕਰੋਨਾ ਨਾਲ ਵਿੱਚ ਵੀ ਸਾਰੇ ਧਰਮਾਂ ਦੇ ਲੋਕਾਂ ਨੇ ਦਰਵਾਜ਼ੇ ਬੰਦ ਕੀਤੇ ਸੀ ਪਰ ਸਿੱਖ ਧਰਮ ਦੇ ਭਾਈਚਾਰੇ ਨੇ ਘਰ ਘਰ ਜਾ ਕੇ ਗੁਰੂ ਦਾ ਲੰਗਰ ਪਹੁੰਚਾਇਆ ਸੀ ਇਹ ਸਾਡੇ ਸਾਡੇ ਸੇਵਾ ਗੁਰੂਆਂ ਦੇ ਘਰਾਂ ਵਿੱਚ ਵੀ ਕੀਤੀ ਜਾਂਦੀ ਸੀ ਜਿਵੇਂ ਕਿ ਲੰਗਰ ਦੀ ਸੇਵਾ ਬਰਤਨਾਂ ਦੀ ਸੇਵਾ ਸਾਫ ਸਫਾਈਆਂ ਦੀ ਸੇਵਾ ਨਾਲ ਜੋੜਿਆ ਜਾਂਦਾ ਸੀ ਸੇਵਾ ਹੋਰ ਕਈ ਪ੍ਰਕਾਰ ਦੀਆਂ ਵੀ ਹੁੰਦੀਆਂ ਹਨ ਮੇਰੇ ਤਰੀਕੇ ਨਾਲ ਤਾਂ ਸਭ ਤੋਂ ਵੱਡੀ ਸੇਵਾ ਗਰੀਬਾਂ ਦੀ ਸੇਵਾ ਹੈ ਬਿਮਾਰ ਮਰੀਜ਼ ਨੂੰ ਦਵਾਈ ਦੇਣ ਦੀ ਸੇਵਾ ਕਰਨੀ ਚਾਹੀਦੀ ਹੈ ਸਿੱਖਿਆ ਦੀ ਸੇਵਾ ਸਕੂਲਾਂ ਵਿੱਚ ਵੀ ਠੀਕ ਹੋਣੀ ਚਾਹੀਦੀ ਹੈ ਗਰੀਬਾਂ ਨੂੰ ਕੋਈ ਕੱਪੜੇ ਦੀ ਜ਼ਰੂਰਤ ਹੋਵੇ ਤਾਂ ਕਰਨੀ ਚਾਹੀਦੀ ਹੈ ਜੇਕਰ ਕਿਸੇ ਨੂੰ ਪੈਸੇ ਦੀ ਜ਼ਰੂਰਤ ਹੋਵੇ ਤਾਂ ਪੈਸੇ ਦੀ ਵੀ ਸੇਵਾ ਕਰਨੀ ਚਾਹੀਦੀ ਹੈ